ਪੰਜਾਬ ਦੀ ਵੰਡ ਦੇ ਦੌਰਾਨ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਖ਼ਰਾਬ ਸੀ ਉਦੋਂ ਲੋਕਾਂ ਕੋਲ ਪਾਉਣ ਹੰਡਾਉਣ ਦੇ ਲਈ ਕੁਛ ਵੀ ਨਹੀਂ ਸੀ ਖਾਣ ਪੀਣ ਨੂੰ ਵੀ ਚੱਜ ਨਾਲ ਨਹੀਂ ਮਿਲਦੀ ਸੀ ਚੀਜ਼ਾਂ ਅਤੇ ਰੋਟੀ ਕੱਪੜਾ ਮਕਾਨ ਜੋ ਕਿ ਬਹੁਤ ਹੀ ਜ਼ਰੂਰੀ ਜ਼ਰੂਰੀ ਹਨ ਚੀਜ਼ਾਂ ਉਹ ਵੀ ਨਹੀਂ ਸਨ ਮਿਲਦੀਆਂ ਪਰ ਅੱਜ ਦਾ ਪੰਜਾਬ ਉਸ ਟਾਈਮ ਦੇ ਪੰਜਾਬ ਨਾਲੋਂ ਬਹੁਤ ਹੀ ਤਰੱਕੀ ਕਰ ਚੁੱਕਿਆ ਹੈ ਲੋਕਾਂ ਕੋਲ ਕੰਮਕਾਜ ਵੀ ਹਨ ਜਿਵੇਂ ਕਿ ਉਸ ਟਾਈਮ 'ਤੇ ਸਾਰੇ ਜਾਣੇ ਹੀ ਗਰੀਬ ਸਨ

ਬਹੁਤ ਹੀ ਪਿਛੋਕੜ ਸੋਚਦੇ ਵੀ ਸਨ ਅਤੇ ਹੈਗੇ ਵੀ ਪਿਛੜੇ ਹੋਏ ਸਨ ਪਰ ਅੱਜ ਗਾਵਾਂ ਤੋਂ ਸਾਰੇ ਜਾਣੇ ਸ਼ਹਿਰਾਂ ਵਿੱਚ ਆ ਕੇ ਵੱਸ ਰਹੇ ਹਨ ਜੋ ਕਿ ਬਹੁਤ ਹੀ ਵਧੀਆ ਚੀਜ਼ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਪੰਜਾਬ ਹੋਰ ਵੀ ਤਰੱਕੀ ਕਰੇਗਾ ਜੋ ਅੰਗਰੇਜ਼ਾਂ ਨੇ ਸਾਨੂੰ ਬੁਰਾ ਟਾਈਮ ਵਿਖਾਇਆ ਹੈ ਉਹ ਸਾਰਾ ਟਾਈਮ ਬਿਲਕੁਲ ਹੀ ਸਹੀ ਹੋ ਜਾਵੇਗਾ ਅਤੇ ਲੋਕ ਖੁਸ਼ੀਆਂ ਮਨਾਉਣਗੇ ਸਾਡੀ ਸਰਕਾਰ ਨੇ ਵੀ ਬਹੁਤ ਹੀ ਤਰੱਕੀ ਕੀਤੀ ਹੈ ਪਹਿਲਾਂ ਦੇ ਟਾਈਮ 'ਤੇ ਲੋਕ ਮਜ਼ਦੂਰੀ ਕਰਦੇ ਸਨ ਅੰਗਰੇਜ਼ਾਂ ਦੇ ਅੰਡਰ ਪਰ ਅੱਜ ਦੇ ਟਾਈਮ 'ਤੇ ਸਰਕਾਰ ਨੌਜਵਾਨਾਂ ਨੂੰ ਵੀ ਨੌਕਰੀਆਂ ਦੇ ਰਹੀ ਹੈ ਅਤੇ ਨਾਲੇ ਹਰ ਸਾਲ ਹੀ ਪੋਸਟਾਂ ਵੱਧਦੀਆਂ ਹਨ ਨੌਕਰੀ ਦੀਆਂ ਜਿਸ ਕਾਰਨ ਕਿ ਆਰਥਿਕ ਪ੍ਰਭਾਵ ਦੀ ਸਥਿਤੀ ਬਹੁਤ ਹੀ ਵਧੀਆ ਹੋਈ ਹੈ ਪਹਿਲਾਂ ਦੇ ਸਮੇਂ ਨਾਲੋਂ ਅਤੇ ਅੱਜ ਦਾ ਪੰਜਾਬ ਹੀ ਭਵਿਸ਼ਿਆ ਵਿੱਚ ਹੋਰ ਵਧੀਆ ਬਣੇਗਾ